ਵੈਸੇ ਤਾਂ ਪੰਜਾਬ ਵਿੱਚ ਜਿਹੜੇ ਹੈਗੇ ਹੈ ਕਬੀਲੇ ਜਿਹੜੇ ਕਬਾਇਲੀ ਜਿਹੜੇ ਖੇਤਰ ਹੈਗੇ ਹੈ ਉਹ ਪਾਏ ਨਹੀਂ ਜਾਂਦੇ ਹੈਗੇ ਹੈ ਕਿਉਂਕਿ ਜਿਹੜੇ ਜ਼ਿਆਦਾਤਰ ਜਿਹੜੇ ਇਹ ਹੁੰਦੇ ਹੈ ਕਬਾਇਲੀ ਖੇਤਰ ਹੁੰਦੇ ਹੈਗੇ ਹੈ ਇਹ ਜੰਗਲਾਂ ਵਗੈਰਾ 'ਚ ਪਾਏ ਜਾਂਦੇ ਹੈਗੇ ਹੈ ਜਿਹੜੇ ਪੰਜਾਬ 'ਚ ਹੈਗੇ ਜੰਗਲ ਬਹੁਤ ਜ਼ਿਆਦਾ ਘੱਟ ਮਾਤਰਾ 'ਚ ਮਿਲਦੇ ਬਹੁਤ ਜ਼ਿਆਦਾ ਘੱਟ ਤਾਂ ਨਹੀਂ ਕਿਹਾ ਜਾ ਸਕਦਾ ਮਤਲਬ ਘੱਟ ਮਿਲਦੇ ਹੈਗੇ ਹੈ ਅਤੇ ਜਿੱਥੇ ਜੰਗਲ ਮਿਲਦੇ ਵੀ ਹੈਗੇ ਹੈ ਉੱਥੇ ਜਿਹੜੇ ਹੈਗੇ ਹੈ ਕਬੀਲੇ ਵਗੈਰਾ ਜਿਹੜੇ ਹੈਗੇ ਹੈ ਉਹ ਪਾਏ ਨਹੀਂ ਜਾਂਦੇ ਹੈਗੇ ਹੈ ਇਸ ਕਰਕੇ ਜਿਹੜੇ ਹੈਗੇ ਹੈ ਵੈਸੇ ਆਪਾਂ ਜਿੱਦਾਂ ਦੇਖਿਆ ਜਾ ਸਕਦਾ ਜਿਹਦੇ ਜਿਹੜੇ ਜਿਹੜੇ ਖੇਤਰਾਂ 'ਚ ਜਿੱਦਾਂ ਕਬੀਲੇ ਮਿਲਦੇ ਹੈਗੇ ਹੈ ਉਨ੍ਹਾਂ ਨੂੰ ਜਿਹੜਾ ਹੈਗਾ ਹੈ ਮੁੱਖ ਤੌਰ 'ਤੇ ਕਾਫੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਜਿੱਦਾਂ ਹੁਣ ਮੰਨ ਲਉ ਸਿੱਖਿਆ ਪਹਿਲਾਂ ਜਿਹੜੀ ਸਿੱਖਿਆ ਹੈਗੀ ਹੈ ਉਨ੍ਹਾਂ ਨੂੰ ਪਹਿਲਾਂ ਜਿੱਦਾਂ ਹੁਣ ਆਪਾਂ ਕਿਸੇ ਨੂੰ ਜੇ ਕੁਛ ਵੀ ਆਪਾਂ ਐਜੂਕੇਟ ਕਰਨਾ ਚਾਹੁੰਦੇ ਹੈ ਕਿਸੇ ਨੂੰ ਵੀ ਕਿਸੇ ਨੂੰ ਆਪਾਂ ਕੁਛ ਸਿਖਾਉਣਾ ਚਾਹੁੰਦੇ ਹੈਗੇ ਪਹਿਲਾਂ ਸਾਨੂੰ ਉਨ੍ਹਾਂ ਦੀ ਭਾਸ਼ਾ ਵਗੈਰਾ ਆਉਣੀ ਚਾਹੀਦੀ ਹੈਗੀ ਹੈ ਅਤੇ ਭਾਸ਼ਾ ਵਗੈਰਾ ਸਿਖਾਉਣ ਵਿੱਚ ਸਾਨੂੰ ਉਨ੍ਹਾਂ ਨੂੰ ਪਹਿਲਾਂ ਉਨ੍ਹਾਂ ਨਾਲ ਇੰਟ੍ਰੈਕਟ ਵਗੈਰਾ ਹੋਣਾ ਪੈਂਦਾ ਹੈਗਾ ਹੈ ਹੈਂਅ ਉਹਦੇ ਬਾਅਦ 'ਚ ਭਾਸ਼ਾ ਵਗੈਰਾ 'ਚ ਉਨ੍ਹਾਂ ਨੂੰ ਮਤਲਬ ਕਾਫੀ ਜ਼ਿਆਦਾ ਉਹਦੇ ਨਾਲ ਸਿੱਖਿਆ ਉਨ੍ਹਾਂ ਨੂੰ ਜੋ ਉਹ ਆਉਂਦੀ ਹੈਗੀ ਅਤੇ ਸਿਹਤ ਸੰਭਾਲ ਵਾਸਤੇ ਉਨ੍ਹਾਂ ਨੂੰ ਉੱਥੇ ਜਿਹੜੇ ਐਦਾਂ ਕਬੀਲੇ ਹੈ ਜੰਗਲਾਂ ਵਿੱਚ ਰਹਿੰਦੇ ਹੈਗੇ ਅਤੇ ਜੰਗਲਾਂ ਵਿੱਚ ਉਨ੍ਹਾਂ ਨੂੰ ਹੋਸਪੀਟਲ ਵਗੈਰਾ ਜਾਂ ਕੁਛ ਵੀ ਜਿਹੜੀਆਂ ਸਿਹਤ ਸੰਬੰਧੀ ਜਿਹੜੀਆਂ ਵੀ ਸਹੂਲਤਾਂ ਹੁੰਦੀਆਂ ਹੈਗੀਆਂ ਹੈ ਉਹ ਦੇਣੀਆਂ ਮਤਲਬ ਮਾੜੀ ਮੋਟੀ ਤਾਂ ਆਪਾਂ ਪ੍ਰੋਵਾਈਡ ਕਰ ਸਕਦੇ ਹੈਗੇ ਹੈ ਜਿਹੜੀ ਮਤਲਬ ਜ਼ਿਆਦਾ ਜਿਹੜੀਆਂ ਸਹੂਲਤਾਂ ਹੁੰਦੀਆਂ ਹੈ ਉਨ੍ਹਾਂ ਨੂੰ ਉੱਥੇ ਉਹ ਹੋਸਪੀਟਲ ਵਗੈਰਾ ਜਾਂ ਕੁਛ ਵੀ ਜਿਹੜੇ ਓਪਰੇਸ਼ਨ ਥੀਏਟਰ ਜਾਂ ਕੋਈ ਹੋਰ ਵੀ ਜਿਹੜੀ ਚੀਜ਼ਾਂ ਹੁੰਦੀਆਂ ਹੈਗੀਆਂ ਮਾੜੀ ਮੋਟੀ ਫਸਟ ਏਡ ਵਗੈਰਾ ਪ੍ਰੋਵਾਈਡ ਕਰ ਸਕਦੇ ਜ਼ਿਆਦਾ ਉਨ੍ਹਾਂ ਨੂੰ ਉਹ ਪ੍ਰੋਵਾਈਡ ਨਹੀਂ ਉੱਥੇ ਕੀਤੀਆਂ ਜਾ ਸਕਦੀਆਂ ਹੈਗੀਆਂ ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਹੈਗੀਆਂ ਹੈ ਉਨ੍ਹਾਂ ਨੂੰ ਜਿਹੜੀਆਂ ਹੈਗੀਆਂ ਬੁਨਿਆਦੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਹੈ